ਜੋ ਕਿ ਮੋਟਰਸਾਈਕਲ ਚਲਾਉਣ ਵੇਲੇ ਸਾਨੂੰ ਧਿਆਨ ਰੱਖਣਾ ਚਾਹੀਦਾ ਹਨ ਉਹ ਹੈ ਜੀ ਰੋਡੇ ਬੰਦੇ ਨੂੰ ਤਾਂ ਹੈਲਮਟ ਬਹੁਤ ਜਰੂਰੀ ਹੈ ਸਰਦਾਰ ਬੰਦੇ ਨੂੰ ਪੱਗ ਪਰਨਾ ਇਹ ਤਾਂ ਰੱਖਣੇ ਹੀ ਪੈਂਦੇ ਹਨ ਸਿਰ 'ਤੇ ਕਦੇ ਹਮੇਸ਼ਾ ਨੰਗੇ ਸਿਰ ਮੋਟਰਸਾਈਕਲ ਨਹੀਂ ਚਲਾਉਣਾ ਚਾਹੀਦਾ ਹੈ ਜੇ ਰੱਬ ਨਾ ਕਰੇ ਐਕਸੀਡੈਂਟ ਹੋ ਜਾਵੇ ਉਸ ਵਿੱਚ ਸਿਰ ਨੂੰ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਅਤੇ ਹਮੇਸ਼ਾ ਆਪਣੀ ਸਾਈਡ ਦੱਬ ਕੇ ਚੱਲੋ ਅਤੇ ਕਿਸੀ ਦੀ ਗੱਡੀਆਂ ਵਾਲ਼ੇ ਟਰੈਕ 'ਚ ਨਾ ਲਿਆਓ ਮੋਟਰਸਾਈਕਲ ਦਾ ਟਰੈਕ ਅਲੱਗ ਬਣਾਇਆ ਹੁੰਦਾ ਸੜਕ 'ਤੇ ਜਾਂ ਸੜਕ ਦੇ ਸਾਈਡ 'ਤੇ ਹੋ ਕੇ ਚੱਲੋ ਤਾਂ ਕਿ ਵੱਡੀਆਂ ਗੱਡੀਆਂ ਸਾਨੂੰ ਆਸਾਨੀ ਨਾਲ ਓਵਰਟੇਕ ਕਰ ਸਕਣ ਅਤੇ ਇਹ ਸਭ ਤੋਂ ਜਰੂਰੀ ਹੈ ਕਿਉਂਕਿ ਵੱਡੀਆਂ ਗੱਡੀਆਂ ਵਾਲ਼ੇ ਤੇਜ਼ ਜਾਂਦੇ ਹਨ ਅਤੇ ਜਦੋਂ ਵੀ ਯਾਤਰਾ ਕਿਤੇ ਕਰਦੇ ਹਨ ਮੋਟਰਸਾਈਕਲ ਰਾਹੀਂ ਜਾਂ ਕੁਛ ਵੀ ਚੀਜ਼ ਰਾਹੀਂ ਮੁੱਖ ਦਸਤਾਵੇਜ਼ ਉਹਨਾਂ ਦੇ ਹਨ ਕਾਗਜ਼ ਜਿਵੇਂ ਕਿ ਆਰ ਸੀ ਹੋ ਗਈ ਇਨਸ਼ੋਰੈਂਸ ਹੋ ਗਈ ਪੋਲਿਊਸ਼ਨ ਹੋ ਗਿਆ ਇਹ ਮੁੱਖ ਦਸਤਾਵੇਜ਼ ਹੁੰਦੇ ਹਨ ਅਤੇ ਇੱਕ ਲਾਈਸੈਂਸ ਬਹੁਤ ਜ਼ਰੂਰੀ ਹੁੰਦਾ ਹੈ ਜੋ ਕਿ ਬੰਦਾ ਚਲਾਉਂਦਾ ਹੈ ਅਤੇ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਹੈ ਅਤੇ ਆਪਣੇ ਕੋਲ ਹਮੇਸ਼ਾ ਰੱਖਣੇ ਜਾਂਦ ਚਾਹੀਦੇ ਹਨ ਜਦੋਂ ਆਪਾਂ ਜਾਂਦੇ ਹਨ